ਮੇਰੇ ਹਸਬੈਂਡ ਜੋ ਇੱਕ ਕੰਪਨੀ ਵਿੱਚ ਕੰਮ ਕਰਦੇ ਹਨ ਉਹਨਾਂ ਦੀ ਟਰਾਂਸਫਰ ਅਸਾਮ ਹੋ ਚੁੱਕੀ ਹੈ ਅਤੇ ਉੱਥੇ ਸਾਨੂੰ ਜੋ ਫਲੈਟ ਮਿਲਿਆ ਹੈ ਉਸ ਦੇ ਵਿੱਚ ਸਿੱਧਾ ਹੀ ਗੈਸ ਦੀ ਸਪਲਾਈ ਕੀਤੀ ਗਈ ਹੈ ਜਿਸ ਨਾਲ ਹੁਣ ਸਾਨੂੰ ਸਿਲੰਡਰ ਦੀ ਬੁਕਿੰਗ ਕਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਸਾਨੂੰ ਹੁਣ ਗੈਸ ਦੀ ਗੈਸ ਦੇ ਸਿਲੰਡਰ ਦੀ ਵੀ ਜਰੂਰਤ ਮਹਿਸੂਸ ਨਹੀਂ ਹੈ ਕਿਉਂਕਿ ਉੱਥੇ ਸਿੱਧਾ ਹੀ ਸਪਲਾਈ ਘਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਅਤੇ ਜਿਸ ਕਰਕੇ ਗੈਸ ਸਿਲੰਡਰ ਹੁਣ ਸਾਨੂੰ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਇਸ ਕਰਕੇ ਸਾਡੀ ਇਹ ਬੁਕਿੰਗ ਰੱਦ ਕੀਤੀ ਜਾਵੇ ਕਿਉਂਕਿ ਹੁਣ ਸਾਨੂੰ ਇਸ ਬੁਕਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਉਹਨਾਂ ਉੱਥੇ ਸਿੱਧਾ ਹੀ ਘਰਾਂ ਦੇ ਵਿੱਚ ਗੈਸ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਜਿਸ ਕਰਕੇ ਹੁਣ ਸਾਨੂੰ ਇਸ ਇਹ ਲੱਗਦਾ ਹੈ ਕਿ ਸਾਨੂੰ ਗੈਸ ਸਲੰਡਰ ਨਹੀਂ ਚਾਹੀਦਾ ਇਸ ਕਰਕੇ ਸਾਡੀ ਗੈਸ ਦੀ ਬੁਕਿੰਗ ਨੰਬਰ ਬੁਕਿੰਗ ਦਾ ਨੰਬਰ ਤਿੰਨ ਚਾਰ ਪੰਜ ਨੂੰ ਰੱਦ ਕੀਤਾ ਜਾਵੇ